ਮੈਂ ਆਪਣੇ ਲਾਗੇ ਮੰਦਰ ਦੇ ਵਿੱਚ ਜਾਂਦੀ ਹਾਂ ਅਤੇ ਉੱਥੇ ਮੈਨੂੰ ਪੰਜਾਹ ਤੋਂ ਸੌ ਬੰਦਿਆਂ ਦਾ ਖਾਣਾ ਬਣਾਉਣਾ ਪਿਆ ਜਿਸ ਵਿੱਚ ਮੈਨੂੰ ਕਾਫੀ ਟਾਈਮ ਲੱਗਾ ਬਟ ਫਿਰ ਵੀ ਮੈਂ ਉਹਦੇ ਤੋਂ ਉਹਨੂੰ ਜ਼ਿਆਦਾ ਤੇਜ਼ ਕਰਨ ਵਾਸਤੇ ਸਬਜ਼ੀਆਂ ਨੂੰ ਪਹਿਲੇ ਕੱਟਿਆ ਕੱਟ ਕੱਟ ਕੇ ਰੱਖਿਆ ਤੜਕੇ ਤਿਆਰ ਕੀਤੇ ਆਟਾ ਊਟਾ ਗੁੰਨ ਕੇ ਰੱਖਿਆ ਤਾਂ ਕਿ ਮੈਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਅਤੇ ਵਧੇਰੇ ਤੋਂ ਵਧੇਰੇ ਲੋਕਾਂ ਨੂੰ ਜਲਦੀ ਤੋਂ ਜਲਦੀ ਮਤਲਬ ਰੋਟੀ ਮਿਲ ਜਾਵੇ ਅਤੇ ਮੈਨੂੰ ਜ਼ ਸਬਜ਼ੀਆਂ ਬਣਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਅਤੇ ਮੈਂ ਬਹੁਤ ਹੀ ਅੱਛੀ ਅੱਛੀ ਸਬਜ਼ੀਆਂ ਬਣਾ ਲੈਂਦੀ ਹਾਂ ਜਿਸ ਦੇ ਕਾਰਨ ਲੋਕ ਮਤਲਬ ਮੰਦਰ ਦੇ ਭਗਤ ਜਿਹੜੇ ਆ ਬਹੁਤ ਜ਼ਿਆਦਾ ਪਸੰਦ ਕਰਦੇ ਆ ਸਬਜ਼ੀਆਂ ਅਤੇ ਮੈਂ ਵੱਧ ਤੋਂ ਵੱਧ ਸਬਜ਼ੀਆਂ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਵੱਧ ਤੋਂ ਵੱਧ ਰੋਟੀ ਮਤਲਬ ਕਰਦੀ ਹਾਂ ਕਿ ਪਹਿਲੇ ਮੈਂ ਤਿਆਰੀ ਕੀ ਰੱਖਾਂ ਤਾਂ ਜਿਹਦੇ ਨਾਲ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਪ੍ਰੋਬਲਮ ਨਾ ਆਵੇ ਅਤੇ ਮੈਂ ਉਹਦੇ ਕਰਕੇ ਉਹ ਸਾਰੇ ਭਗਤ ਆਰਾਮ ਨਾਲ ਵਰਤੇ ਜਾਂਦੇ ਨੇ ਪ੍ਰਸ਼ਾਦ ਉਹਨਾਂ ਨੂੰ ਵਰਤਿਆ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸਬਜ਼ੀਆਂ ਅਤੇ ਮੈਂ ਇਹੀ ਹੈ ਤਜ਼ਰਬਾ ਮੇਰਾ ਆਹੀ ਆ ਕਿ ਮੈਂ ਇਹਨੂੰ ਪਹਿਲੇ ਤੋਂ ਪਹਿਲੇ ਤਿਆਰੀ ਰੱਖਾਂ ਜਿਹਦੇ ਨਾਲ ਉਹਨਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ ਅਤੇ ਉਹ ਆਪਣੀਆਂ ਮਤਲਬ ਉਹਨਾਂ ਨੂੰ ਲੋੜੀਂਦਾ ਜਿਹੜੀਆਂ ਉਹਨਾਂ ਦੀਆਂ ਸਬ ਹੈਗੀਆਂ ਮਨਪਸੰਦ ਚੀਜ਼ਾਂ ਡਿਸ਼ਾਂ ਉਹ ਉਹਨਾਂ ਨੂੰ ਮਿਲਦੀਆਂ ਰਹਿਣ